ਜਦੋਂ ਵੀ ਮੈਂ ਕੋਈ ਲਿਖਤ ਲਿਖਦਾ ਹਾਂ ਤਾਂ ਉਸ ਵਿੱਚ ਆਮ ਲੇਖਕਾਂ ਤੋਂ ਵੱਖਰਾਪਣ ਇਹ ਦਿਖਾਉਂਦਾ ਹਾਂ ਕਿ ਜਿਸ ਵਿਸ਼ੇ 'ਤੇ ਵੀ ਮੈਂ ਲਿਖਣਾ ਹੋਵੇ ਉਸ ਦੀ ਕੁਝ ਇੱਕ ਸੰਮਰੀ ਮੈਂ ਪਹਿਲਾਂ ਹੀ ਦਿਖਾ ਦਿੰਦਾ ਹਾਂ ਜਿਵੇਂ ਕਿ ਮੈਂ ਅਗਰ ਆਪਣੇ ਵਾਤਾਵਰਨ ਬਾਰੇ ਲਿਖਣਾ ਹੋਵੇ ਤਾਂ ਮੈਂ ਥੋੜ੍ਹਾ ਜਿਹਾ ਕੁਛ ਸ਼ਬਦਾਂ ਨੂੰ ਇਸ ਤਰ੍ਹਾਂ ਨਾਲ ਉੱਥੇ ਲਿਖਦਾ ਹਾਂ ਕਿ ਮੇਰੇ ਪੜ੍ਹਨ ਵਾਲੇ ਪਾਠਕ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਵਾਤਾਵਰਨ ਦੀਆਂ ਗੱਲਾਂ ਅੱਗੇ ਹੋਣ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਉਹ ਬੜੇ ਰੀਝ ਨਾਲ ਪੜ੍ਹਦਾ ਹੈ ਕਿ ਦੇਖਾਂ ਕਿ ਅਗਰ ਵਾਤਾਵਰਨ ਦੇ ਵਿੱਚ ਕੀ ਕੀ ਆਪਾਂ ਕਰ ਸਕਦੇ ਹਾਂ ਵਾਤਾਵਰਨ ਦੇ ਸਾਡੇ ਜ਼ਿੰਦਗੀ ਦੇ ਕੀ ਕੀ ਪ੍ਰਭਾਵ ਪੈਂਦੇ ਹਨ ਇਸ ਤਰ੍ਹਾਂ ਦੇ ਨਾਲ ਕਿਸੇ ਵੀ ਵਿਸ਼ੇ 'ਤੇ ਜਦੋਂ ਮੈਂ ਲਿਖਦਾ ਹਾਂ ਤਾਂ ਉਸ ਵਿੱਚ ਮੈਂ ਪੂਰਾ ਇਸ ਗੱਲ ਨੂੰ ਧਿਆਨ ਨਾਲ ਰੱਖਦਾ ਹਾਂ ਕਿ ਪੜ੍ਹਨ ਵਾਲੇ ਨੂੰ ਕੋਈ ਜ਼ਿਆਦਾ ਔਖਾ ਨਾ ਹੋਣਾ ਪਵੇ ਅਤੇ ਉਹਨੂੰ ਬੜੇ ਸਰਲ ਤਰੀਕੇ ਦੇ ਨਾਲ ਹਰ ਚੀਜ਼ ਸਮਝ ਆ ਜਾਵੇ ਜੋ ਮੈਂ ਕਰਨੀ ਚਾਹੁੰਦਾ ਹਾਂ ਔਰ ਹਰ ਲਿਖਤ ਦੇ ਵਿੱਚ ਮੇਰਾ ਇੱਕੋ ਹੀ ਰੁਝਾਨ ਹੁੰਦਾ ਹੈ ਕਿ ਪੜ੍ਹਨ ਵਾਲੇ ਨੂੰ ਉਸ ਦੇ ਵਿੱਚ ਕੁਛ ਇੰਟਰਸਟ ਬਣਿਆ ਰਹੇ ਅਤੇ ਉਹ ਬੋਰ ਨਾ ਮਹਿਸੂਸ ਕਰੇ ਤਾਂ ਕਿ ਉਸ ਨੂੰ ਪੜ੍ਹਦੇ ਪੜ੍ਹਦੇ ਕੁਛ ਅੱਛੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਣ ਅਤੇ ਉਸਦਾ ਮਨ ਵੀ ਲੱਗਿਆ ਰਹੇ ਇਸ ਤਰ੍ਹਾਂ ਨਾਲ ਲਿਖਣ ਵੇਲੇ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਦੇ ਹੋਏ ਲਿਖਦਾ ਹਾਂ ਅਤੇ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਿਖਾਉਂਦਾ ਹਾਂ